ਅੱਜ ਦੇ ਸਮੇਂ ਵਿੱਚ ਵਿਗਿਆਨ ਨੇ ਕਾਫ਼ੀ ਤਰੱਕੀ ਕਰ ਲਈ ਹੈ ਦੇਸ਼ ਨੂੰ ਬਹੁਤ ਅੱਗੇ ਲੈ ਕੇ ਗਏ ਹਨ ਭਾਵੇਂ ਅੱਜ ਦੁਨੀਆਂ ਚੰਨ 'ਤੇ ਵੀ ਪਹੁੰਚ ਗਈ ਹੈ ਪਰ ਕੁਝ ਲੋਕ ਹਨ ਜੋ ਵਹਿਮਾਂ ਭਰਮਾਂ ਨੂੰ ਬਹੁਤ ਮੰਨਦੇ ਹਨ ਅਤੇ ਇਹਨਾਂ ਉੱਤੇ ਬਹੁਤ ਵਿਸ਼ਵਾਸ ਕਰਦੇ ਹਨ ਅਸੀਂ ਕੁਛ ਉਦਾਹਰਣ ਵੀ ਲੈ ਸਕਦੇ ਹਾਂ ਜਿਵੇਂ ਘਰ ਵਿੱਚ ਕੰਮ ਕਰਦੇ ਹੋਏ ਜਾਂ ਚਲਦੇ ਫਿਰਦੇ ਸਾਡੇ ਤੋਂ ਕੋਈ ਕੱਚ ਟੁੱਟ ਜਾਏ ਤਾਂ ਘਰ ਦੇ ਵੱਡੇ ਸਾਨੂੰ ਬੋਲਦੇ ਹਨ ਕਿ ਕੱਚ ਦਾ ਟੁੱਟਣਾ ਸ਼ੁੱਭ ਨਹੀਂ ਮੰਨਿਆ ਜਾਂਦਾ ਇਸਨੂੰ ਅਸ਼ੁੱਭ ਮੰਨਦੇ ਹਨ ਅਜਿਹੇ ਕੁਝ ਹੋਰ ਵੀ ਉਦਾਹਰਣ ਅਸੀਂ ਲੈ ਸਕਦੇ ਹਾਂ ਜਿਵੇਂ ਦੁੱਧ ਦਾ ਉਬਲਣਾ ਵੀ ਸ਼ੁੱਭ ਨਹੀਂ ਮੰਨਿਆ ਜਾਂਦਾ ਕਾਲਾ ਜਾਦੂ ਵੀ ਇਸ ਅਜਿਹੇ ਵਹਿਮਾਂ ਭਰਮਾਂ ਦਾ ਹੀ ਇੱਕ ਉਦਾਹਰਣ ਹੈ ਅਸੀਂ ਇੱਕ ਹੋਰ ਉਦਾਹਰਣ ਲੈ ਸਕਦੇ ਹਾਂ ਜਿੱਦਾਂ ਅਸੀਂ ਰਸਤੇ 'ਤੇ ਜਾ ਰਹੇ ਹੋਈਏ ਤਾਂ ਬਿੱਲੀ ਸਾਡੇ ਰਸਤੇ ਤੋਂ ਗੁਜ਼ਰ ਜਾਏ ਤਾਂ ਉਸ ਨੂੰ ਸ਼ੁੱਭ ਨਹੀਂ ਮੰਨਦੇ ਕਈ ਇਹਨਾਂ ਵਹਿਮ ਭਰਮਾਂ ਵਿੱਚ ਵਿਸ਼ਵਾਸ ਕਰਕੇ ਆਪਣਾ ਰ ਰਾਹ ਵੀ ਬਦਲ ਲੈਂਦੇ ਹਨ ਅਜਿਹੇ ਕੁਛ ਹੋਰ ਵੀ ਹੁੰਦੇ ਹਨ ਜਿਹੜੇ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਕਰਦੇ ਹਨ ਪਰ ਅਜਿਹਾ ਕੁਛ ਨਹੀਂ ਹੁੰਦਾ ਸਾਨੂੰ ਵਹਿਮਾਂ ਭਰਮਾਂ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ